ਦਸ ਜੂਨ ਦੋ ਹਜ਼ਾਰ ਤੇਈ ਗਿਆਰ੍ਹਾਂ ਅਕਤੂਬਰ ਦੋ ਹਜ਼ਾਰ ਤੇਈ ਪੰਦਰ੍ਹਾਂ ਅਕਤੂਬਰ ਦੋ ਹਜ਼ਾਰ ਤੇਈ ਦੋ ਜਨਵਰੀ ਦੋ ਹਜ਼ਾਰ ਤੇਈ ਪੰਜ ਮਾਰਚ ਦੋ ਹਜ਼ਾਰ ਤੇਈ